ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਪੇਂਟਰਸ ਬੋਲ ਰਹੇ ਹੋ ਤੁਸੀਂ ਹਾਂਜੀ ਅਸੀਂ ਨਾ ਆਪਣੇ ਘਰ ਪੇਂਟ ਕਰਵਾਉਣਾ ਸੀਗਾ ਤਿੰਨ ਰੂਮ ਨੇ ਡਰਾਇੰਗ ਰੂਮ ਕਿਚਨ ਅਤੇ ਲੋਬੀ ਐਂਡ ਓਪਨ ਏਰੀਆ ਓਕੇ ਵਾਲਪੇਪਰ ਲਗਵਾਉਣੇ ਆ ਅਲੱਗ ਅਲੱਗ ਡਿਜਾਇਨਿੰਗ ਦੇ ਸਾਰੇ ਰੂਮ 'ਚ ਡਿਫਰੈਂਟ ਡਿਫਰੈਂਟ ਦੋ ਰੂਮ ਕਿਚਨ ਡਰਾਇੰਗ ਰੂਮ ਅਤੇ ਓਪਨ ਏਰੀਆ ਥੋੜ੍ਹਾ ਹਾਂ ਡਰਾਇੰਗ ਰੂਮ 'ਚ ਕੁਛ ਸਪੈਸ਼ਲ ਚਾਹੀਦਾ ਲੁੱਕ ਵਧੀਆ ਲਾਈਟ ਕਲਰ ਕਿਹੜੇ ਕਿਹੜੇ ਅਵੇ ਹੈ ਅਵੇਲੇਬਲ ਤੁਹਾਡੇ ਕੋਲ ਓਕੇ ਜਿਵੇਂ ਰੂਮ ਦਸ ਸਾਢੇ ਦਸ ਪੰਦਰਾਂ ਬਾਏ ਪੰਦਰਾਂ ਦਾ ਰੂਮ ਹੈ ਆਈਡੀਆ ਦੱਸ ਸਕਦੇ ਕਿੰਨੇ ਰੇਂਜ ਤੱਕ ਹੋ ਜਾਵੇਗਾ ਓਕੇ ਠੀਕ ਹੈ ਕੁਆਲਿਟੀ ਕਿੱਦਾਂ ਦੀ ਹੋਵੇਗੀ ਕੋਈ ਪ੍ਰੋਬਲਮ ਕਿੰਨੇ ਟਾਈਮ ਤੱਕ ਨਹੀਂ ਖਰਾਬ ਹੁੰਦਾ ਆਪਣੇ ਪੇਂਟ ਓਕੇ ਹਾਂਜੀ ਓਨਲੀ ਵਾਲਜ ਔਰ ਉੱਪਰ ਇੰਟੀਰੀਅਰ ਜਿਵੇਂ ਛੱਤ 'ਤੇ ਵੀ ਕਰਵਾਉਣਾ ਸੀ ਡਾਊਨ ਸੀਲਿੰਗ ਵਗੈਰਾ ਕਰਦੇ ਹੋ ਹਾਂ ਅਸੀਂ ਜਿਵੇਂ ਡਾਊਨ ਸਿਲਿੰਗ ਕਰਵਾ ਕੇ ਫਲੈਕਸ ਵਗੈਰਾ ਕਰਵਾਉਣੇ ਹੈ ਓਕੇ ਇੱਕ ਰੂਮ 'ਤੇ ਕਿੰਨੇ ਕੁ ਟਾਈਮ ਲੱਗ ਕੇ ਲੱਗ ਜਾਵੇਗਾ ਕਿੰਨੇ ਮਤਲਬ ਤੁਹਾਡੀ ਲੇਬਰ ਜੋ ਹੈ ਕੰਮ ਕਿੰਨੇ ਕੁ ਦਿਨਾਂ 'ਚ ਫ਼ਿਨਿਸ਼ ਹੋ ਜਾਵੇਗਾ ਹਾਂਜੀ ਸਾਨੂੰ ਪੰਦਰਾਂ ਵੀਹ ਦਿਨਾਂ 'ਚ ਕੰਪਲੀਟ ਚਾਹੀਦਾ ਕੰਮ ਵਧੀਆ ਹੋਵੇ ਐਵੇਂ ਨਹੀਂ ਕਿ ਹੈ ਨਾ ਮਤਲਬ ਕੁਆਲਿਟੀ ਨਾ ਵਧੀਆ ਹੋਵੇ ਕਾਹਲੀ ਕਰਕੇ ਠੀਕ ਹੈ ਜੀ ਕਦੋਂ ਤੋਂ ਸਟਾਰਟ ਕਰ ਸਕਦੇ ਹੋ ਤੁਸੀਂ ਕੋਈ ਕਦੋਂ ਤੋਂ ਕਰਨਾ ਸਟਾਰਟ ਕਰ ਸਕਦੇ ਹੋ ਪੇਂਟ ਸਾਨੂੰ ਕੋਈ ਦਿਖਾ ਸਕਦੇ ਹੋ ਆਈਡੀਆ ਵਗੈਰਾ ਕੋਈ ਤੁਹਾਡੇ ਕੋਲ ਬੁੱਕ ਹੋਵੇ ਜਾਂ ਕੁਛ ਜਿਹਤੇ ਆਪਣੇ ਵਾਲਸ ਦੇ ਜੋ ਵਾਲਪੇਪਰ ਨੇ ਜਾਂ ਪੇਂਟ ਦੇ ਡਿਜ਼ਾਇਨ ਨੇ ਉਹਨਾਂ ਦਾ ਕੋਈ ਨਹੀਂ ਠੀਕ ਹੈ ਅਸੀਂ ਸੰਨ ਤੁਸੀ ਸਾਨੂੰ ਸੈਂਡ ਕਰ ਦਿਓ ਨੰਬਰ ਸੈਂਡ ਕਰ ਦਿੰਦੇ ਹਾਂ ਅਸੀਂ ਸਲੈਕਟ ਕਰਕੇ ਜੋ ਵੀ ਹੋਇਆ ਜਲਦੀ ਤੋਂ ਜਲਦੀ ਸਟਾਰਟ ਕਰਕੇ ਤੁਸੀਂ ਹੈ ਨਾ ਓਕੇ ਜੀ ਓਕੇ ਥੈਂਕ ਯੂ